ਹੈਲੋ ਸਰ ਤੁਸੀਂ ਟੂਰ ਏਜੰਸੀ ਪਹਾੜਗੰਜ ਤੋਂ ਬੋਲ ਰਹੇ ਹੋ ਦਿੱਲੀ ਤੋਂ ਹਾਂਜੀ ਸਰ ਮੈਂ ਸ਼ਕਰਪੁਰ ਥਾਣਾ ਦਿੱਲੀ ਤੋਂ ਬੋਲ ਰਹੀ ਹਾਂ ਅਤੇ ਸਰ ਕੱਲ੍ਹ ਤੁਹਾਡੀ ਏਜੰਸੀ ਤੋਂ ਨਾ ਅਸੀਂ ਇੱਕ ਕਾਰ ਬੁੱਕ ਕਰਵਾਈ ਸੀ ਠੀਕ ਹੈ ਅਸੀਂ ਜਾਣਾ ਸੀਗਾ ਗੁਰਦੁਆਰਾ ਸੀਸ ਗੰਜ ਸਾਹਿਬ ਜਿ ਜਿਹੜਾ ਕਿ ਡਰਾਇਵਰ ਨੂੰ ਅੱਜ ਸੱਤ ਵਜੇ ਸਵੇਰ ਦਾ ਟਾਈਮ ਦਿੱਤਾ ਸੀ ਪਰ ਹੁਣ ਤੁਸੀਂ ਦੇਖੋ ਕਿ ਸਵੇਰ ਦੇ ਨੌ ਵੱਜ ਚੁੱਕੇ ਆ ਪਰ ਹਾਲੇ ਤੱਕ ਤੁਹਾਡਾ ਜਿਹੜਾ ਕਾਰ ਨਾ ਉਹ ਆਈ ਅਤੇ ਨਾ ਹੀ ਕਾਰ ਦਾ ਡਰਾਇਵਰ ਪਹੁੰਚਿਆ ਹੈ ਠੀਕ ਹੈ ਅਤੇ ਸਰ ਇਸ ਲਈ ਜਿਹੜਾ ਹੈ ਅਸੀਂ ਤੁਹਾਡੀ ਬੁਕਿੰਗ ਕੀਤੀ ਆ ਉਹਨੂੰ ਤੁਸੀਂ ਕੈਂਸਲ ਕਰ ਦਿਉ ਠੀਕ ਹੈ ਕਿਉਂਕਿ ਅਸੀਂ ਦੋ ਘੰਟੇ ਤੋਂ ਤੁਹਾਡੇ ਡਰਾਈਵਰ ਦੀ ਵੇਟ ਕਰ ਰਹੇ ਹਾਂ ਉਡੀਕ ਕਰ ਰਹੇ ਹਾਂ ਪਰ ਉਹ ਹਾਲੇ ਤੱਕ ਨਹੀਂ ਆਇਆ ਤਾਂ ਤੁਹਾਡੇ ਤੋਂ ਵੀ ਇਹੀ ਉਮੀਦ ਕਰਦੇ ਹਾਂ ਕਿ ਸਰ ਤੁਸੀਂ ਵੀ ਆਪਣੀ ਇੱਕ ਰੈਪੋਟੇਸ਼ਨ ਨੂੰ ਬਰਕਰਾਰ ਰੱਖਣ ਲਈ ਜਿਹੜੇ ਏਦਾਂ ਡਰਾਈਵਰ ਆ ਜਿਹੜੇ ਕਿ ਐਨੇ ਕੇਅਰਲੈੱਸ ਆ ਪਲੀਸ ਇਨ੍ਹਾਂ ਨੂੰ ਥੋੜ੍ਹਾ ਡਾਂਟੋ ਇਨ੍ਹਾਂ ਨੂੰ ਆਪਣੀ ਜਿਹੜੀ ਡਿਊਟੀ ਆ ਉਹ ਉਨ੍ਹਾਂ ਨੂੰ ਦੱਸੋ ਸਮਝਾਉ ਕਿ ਅਗਰ ਕੋਈ ਤੁਹਾਨੂੰ ਬੁੱਕ ਕਰ ਰਿਹਾ ਹੈ ਤੁਹਾਡੀ ਗੱਡੀ ਨੂੰ ਤੁਹਾਡੇ ਪਰ ਵਿਸ਼ਵਾਸ ਕਰਕੇ ਤਾਂ ਜਿੰਨਾ ਟਾਈਮ 'ਤੇ ਤੁਹਾਡੀ ਗੱਲ ਹੋਈ ਹੈ ਓਨੇ ਟਾਈਮ 'ਤੇ ਉੱਥੇ ਪਹੁੰਚੋ ਅਤੇ ਸਰ ਦੋ ਘੰਟੇ ਤੋਂ ਵੱਧ ਹੁਣ ਅਸੀਂ ਤਾਂ ਨਹੀਂ ਉਡੀਕ ਕਰ ਸਕਦੇ ਇਸ ਲਈ ਤੁਹਾਨੂੰ ਫੋਨ ਕੀਤਾ ਹੈ ਕਿ ਤੁਸੀਂ ਜਿਹੜੀ ਅਸੀਂ ਕੱਲ੍ਹ ਬੁਕਿੰਗ ਕਰਵਾਈ ਸੀ ਉਹਨੂੰ ਰੱਦ ਕਰ ਦਿਉ ਅਤੇ ਅਸੀਂ ਹੁਣ ਤੁਹਾਡੇ ਨਾਲ ਨਹੀਂ ਜਾਣਾ ਓਕੇ ਧੰਨਵਾਦ ਸਰ